ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਬਹੁਤ ਸਾਰੀਆਂ ਸੁਖਨਾ ਸੁੱਖੀਆਂ ਜਾਂਦੀਆਂ ਹਨ ਕਈ ਵਾਰ ਕੁਝ ਮੰਨਤਾਂ ਵੀ ਮੰਨੀਆਂ ਜਾਂਦੀਆਂ ਹਨ ਅਤੇ ਕਈ ਖੇਤਰਾਂ ਦੇ ਵਿੱਚ ਕੁਝ ਦੇਵੀ ਦੇਵਤਿਆਂ ਨੂੰ ਪੂਜਿਆ ਵੀ ਜਾਂਦਾ ਹੈ ਕਈ ਪਿੰਡਾਂ ਵਿੱਚ ਜਾਨਵਰਾਂ ਨੂੰ ਬਾਹਰੀ ਅਲਾਮਤਾਂ ਤੋਂ ਬਚਾਉਣ ਲਈ ਅਤੇ ਨਜ਼ਰ ਤੋਂ ਬਚਾਉਣ ਦੇ ਲਈ ਨਜ਼ਰ ਉਤਾਰੀ ਜਾਂਦੀ ਹੈ ਸਾਡੇ ਖੇਤਰ ਵਿੱਚ ਵੀ ਪੁਰਾਣੀਆਂ ਮਾਨਤਾਵਾਂ ਅਨੁਸਾਰ ਪਸ਼ੂਆਂ ਨੂੰ ਇਲਾਜ ਲਈ ਧੂਣੀ ਧੁਖਾਈ ਜਾਂਦੀ ਹੈ ਅਤੇ ਵੱਡੇ ਵਡੇਰਿਆਂ ਤੋਂ ਬਭੂਤੀ ਲਿਆ ਕੇ ਉਹਨਾਂ ਦੇ ਸਰੀਰ 'ਤੇ ਵੀ ਲਗਾਈ ਜਾਂਦੀ ਹੈ ਕੁਝ ਖ਼ਾਸ ਕਿਸਮ ਦਾ ਧੂੰਆਂ ਪਸ਼ੂਆਂ ਦੇ ਰਹਿਣ ਵਾਲੀ ਜਗ੍ਹਾ ਦੇ ਉੱਪਰ ਵੀ ਕੀਤਾ ਜਾਂਦਾ ਹੈ ਇਹਨਾਂ ਟੋਟਕਿਆਂ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹਨਾਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਪਸ਼ੂ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ